ਹੈਲੋ ਟਰੈਵਲਰ ਏਜੰਸੀ ਜਿਸਦਾ ਨਾਮ ਟਰੈਵਲ ਵਿਦ ਅਸ ਹੈ ਕੈਬ ਨੰਬਰ ਨੌ ਨੌ ਚਾਰ ਚਾਰ ਦੇ ਕੈਬ ਡਰਾਈਵਰ ਨਾਲ ਗੱਲ ਕਰ ਰਿਹਾ ਹਾਂ ਐਕਚੁਲੀ ਮੈਨੂੰ ਪਿਕਅਪ ਪਲੇਸ 'ਤੇ ਪਹੁੰਚਣ ਦਾ ਨੋਟੀਫਿਕੇਸ਼ਨ ਮਿਲਿਆ ਸੀ ਪਰ ਮੈਂ ਇੱਥੇ ਪਹੁੰਚ ਕੇ ਦੇਖਿਆ ਹੈ ਕਿ ਤੁਸੀਂ ਇੱਥੇ ਪ੍ਰੈਜੈਂਟ ਨਹੀਂ ਹੋ ਮੈਂ ਤੁਹਾਡੀ ਐਗਜੈਕਟ ਲੋਕੇਸ਼ਨ ਨੂੰ ਪੁੱਛਣਾ ਚਾਹੁੰਦਾ ਹਾਂ ਅਤੇ ਮੇਰੀ ਲੈਂਡਮਾਰਕ ਲੋਕੇਸ਼ਨ ਰਾਜਨ ਫਾਸਟ ਫੂਡ ਹੈ ਜੋ ਕਿ ਜੀ ਟੀ ਰੋਡ ਦੇ ਲੈਫਟ ਸਾਈਡ 'ਤੇ ਹੈ ਇਹ ਨੀਅਰ ਜੋਤੀ ਸਰੂਪ ਚੌਂਕ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਟੈਚੂ ਵੀ ਹੈ ਅਤੇ ਸਾਹਮਣੇ ਕੋਲਜ ਵੀ ਹੈ ਟਰੈਫਿਕ ਲਾਈਟਸ ਵੀ ਉੱਥੇ ਲੱਗੀਆਂ ਹੋਈਆਂ ਹਨ ਜਿੱਥੇ ਮੈਂ ਖੜ੍ਹਾ ਹਾਂ ਮੈਨੂੰ ਜਲਦੀ ਪਹੁੰਚਣ ਦੀ ਕਾਹਲੀ ਹੈ ਇਸ ਕਰਕੇ ਪਲੀਜ਼ ਜਲਦੀ ਆਉਣ ਦੀ ਕਿਰਪਾਲਤਾ ਕੀਤੀ ਜਾਵੇ ਮੈਂ ਉੱਥੇ ਰਾਈਟ ਸਾਈਡ 'ਤੇ ਹਾਂ ਮੇਰੇ ਕੋਲ ਤਿੰਨ ਸੂਟਕੇਸ ਜਿਸ ਵਿੱਚ ਦੋ ਬਲੈਕ ਅਤੇ ਇੱਕ ਬਲੂ ਕਲਰ ਦਾ ਹੈ ਜੇਕਰ ਜ਼ਿਆਦਾ ਕੰਪਲੈਕਸ ਲੋਕੇਸ਼ਨ ਹੈ ਤਾਂ ਮੈਂ ਤੁਹਾਨੂੰ ਲੋਕੇਸ਼ਨ ਦੇ ਕੋਨੇਸ਼ਨ ਨੰਬਰ 'ਤੇ ਵੀ ਭੇਜ ਸਕਦਾ ਹਾਂ